ਛੇ ਜਨਵਰੀ ਉੱਨੀ ਸੌ ਵੀਹ ਅਠਾਰਾਂ ਮਾਰਚ ਉੱਨੀ ਸੌ ਸੰਤਾਲੀ ਵੀਹ ਅਕਤੂਬਰ ਅਠਾਰਾਂ ਸੌ ਸੱਠ ਗਿਆਰਾਂ ਦਸੰਬਰ ਵੀਹ ਸੌ ਇੱਕੀ ਅਠਾਰਾਂ ਅਪ੍ਰੈਲ ਵੀਹ ਸੌ ਵੀਹ